ਮੇਰਾ ਮਨਪਸੰਦ ਭੋਜਨ ਦਾਲ਼ ਰੋਟੀ ਅਤੇ ਘਰ ਦਾ ਬਣਿਆ ਕੋਈ ਵੀ ਹਰੀ ਸਬਜ਼ੀ ਜਾਂ ਖੀਰ ਵਗੈਰਾ ਪਸੰਦ ਹੈ ਜੋ ਕਿ ਮੈਂ ਆਪ ਹੀ ਬਣਾ ਕੇ ਖਾਣਾ ਪਸੰਦ ਕਰਦੀ ਹਾਂ ਬਾਕੀ ਕਦੇ ਕਦੇ ਨੇੜੇ ਦੇ ਰੈਸਟੋਰੈਂਟ ਵਿੱਚ ਜਾਈਦਾ ਤਾਂ ਉੱਥੇ ਜਿਹੜੀ ਚੀਜ਼ ਪਸੰਦ ਹੋਵੇ ਉਹ ਜ਼ਰੂਰ ਖਾਈਦੀ ਹੈ ਅਤੇ ਇੰਨਜੋਏ ਕਰੀਦਾ ਹੈ ਬਸ